ਸਰਕਾਰੀ ਸਕੀਮਾਂ ਦੇ ਵਿੱਚ ਆ ਜਾਂਦੀ ਹੈ ਕਣਕ ਜੋ ਕਿ ਸਰਕਾਰ ਦੇ ਵੱਲੋਂ ਘਰ ਪ੍ਰਤੀ ਇੱਕ ਜੀਅ ਨੂੰ ਪੰਦਰਾਂ ਕਿੱਲੋ ਕਣਕ ਦਿੱਤੀ ਜਾਂਦੀ ਹੈ ਅਤੇ ਸਾਰੇ ਲੋਕ ਇਸ ਸਰਕਾਰੀ ਸਕੀਮ ਦਾ ਖੂਬ ਲਾਭ ਉਠਾਉਂਦੇ ਹਨ ਅਤੇ ਇਸ ਤੋਂ ਬਿਨਾਂ ਡੀਪੂਆਂ ਦੇ ਵਿੱਚ ਦਿੱਤਾ ਜਾਂਦਾ ਤੇਲ ਸੀ ਜੋ ਕਿ ਲੋਕ ਇਸਦਾ ਲਾਭ ਉਠਾਉਂਦੇ ਸੀ ਅਤੇ ਇਸ ਤੋਂ ਬਿਨਾਂ ਹੁਣ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਵੀ ਚੱਲ ਪਏ ਹਨ ਔਰਤਾਂ ਦੇ ਲਈ ਮੁਫਤ ਅਤੇ ਔਰਤਾਂ ਸਰਕਾਰੀ ਬੱਸਾਂ ਦੇ ਵਿੱਚ ਆਪਣਾ ਆਧਾਰ ਕਾਰਟ ਦਿਖਾ ਕੇ ਕਿਤੇ ਵੀ ਆ ਜਾ ਸਕਦੀਆਂ ਹਨ ਅਤੇ ਔਰਤਾਂ ਏ ਜਿਹੜੀਆਂ ਸਰਕਾਰਾਂ ਦੀ ਇਸ ਸਕੀਮ ਦਾ ਕਾਫੀ ਲਾਭ ਉਠਾ ਰਹੀਆਂ ਹਨ ਅਤੇ ਔਰਤਾਂ ਨੂੰ ਕਿਤੇ ਵੀ ਜਾਣ ਦੇ ਵਿੱਚ ਪਰੇਸ਼ਾਨੀ ਨਹੀਂ ਹੁੰਦੀ ਉਹ ਸਰਕਾਰੀ ਸਕੀਮ ਦਾ ਲਾਭ ਉਠਾਉਂਦੀਆਂ ਹੋਈਆਂ ਕਿਤੇ ਵੀ ਜਾ ਸਕਦੀਆਂ ਹਨ